ਇੱਕ ਅਕਤੂਬਰ ਉੱਨੀ ਸੌ ਸਤਾਨਵੇਂ ਦੋ ਜੂਨ ਦੋ ਹਜ਼ਾਰ ਵੀਹ ਪੰਦਰਾਂ ਸਤੰਬਰ ਦੋ ਹਜ਼ਾਰ ਬਾਈ ਅੱਠ ਸਤੰਬਰ ਦੋ ਹਜ਼ਾਰ ਤੇਈ ਚੌਵੀ ਨਵੰਬਰ ਦੋ ਹਜ਼ਾਰ ਚੌਵੀ